ਹਾਂਜੀ ਕਾਫ਼ੀ ਕਿਤਾਬਾਂ ਮੈਂ ਆਨਲਾਈਨ ਮੰਗਾ ਲੈਂਦਾ ਹੁੰਦਾ ਕਿਉਂਕਿ ਬਹੁਤ ਸਾਰੇ ਪਬਲੀਕੇਸ਼ਨ ਆਪਣੀਆਂ ਐਡ ਜਿਹੜੇ ਦਿੰਦੇ ਰਹਿੰਦੇ ਹੈਗੇ ਔਨਲਾਈਨ ਦੇ ਉਹਦੇ ਵਿੱਚ ਮੇਰੇ ਟੇਸਟ ਮੁਤਾਬਕ ਮੈਨੂੰ ਲੋੜ ਮੁਤਾਬਕ ਮੈਨੂੰ ਕਿਤਾਬਾਂ ਮਿਲ ਜਾਂਦੀਆਂ ਹੈਗੀਆਂ ਅਤੇ ਕਾਫ਼ੀ ਕਿਤਾਬਾਂ ਜਿਹੜੀਆਂ ਹੈਗੀਆਂ ਨੇ ਉਹ ਗਰੇਸ਼ੀਅਸ ਪਬਲੀਕੇਸ਼ਨ ਹੈ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਹਮਣੇ ਉੱਥੋਂ ਲੈ ਲਈ ਦੀਆਂ ਮਦਾਨ ਪਬਲੀਕੇਸ਼ਨ ਹੈਗਾ ਹੈ ਯੂਨੀਵਰਸਿਟੀ ਦੇ ਅੰਦਰ ਗੋਲ ਮਾਰਕਿਟ ਦੇ ਵਿੱਚ ਉੱਥੋਂ ਲੈ ਲਈ ਦੀਆਂ ਹੈਗੀਆਂ ਅਤੇ ਦੂਸਰਾ ਜਿਹੜਾ ਹੈਗਾ ਉਹ ਸੈਕਿੰਡ ਹੈਂਡ ਅਤੇ ਸਸਤੀਆਂ ਕਿਤਾਬਾਂ ਦੇ ਸਟੋਰ ਵੀ ਸਾਡੇ ਨੇੜੇ ਯੂਨੀਵਰਸਿਟੀ ਦੇ ਸਾਹਮਣੇ ਮੋਡਰਨ ਕਲੈਕਸ਼ਨ ਮੋਡਰਨ ਬੁੱਕ ਕਲੈਕਸ਼ਨ ਵਾਲੇ ਹੈਗੇ ਆ ਉਥੋਂ ਲੈ ਲਈ ਦੀਆਂ ਹੈਗੀਆਂ ਮੇਰਾ ਪਿੰਡ ਆ ਜਿਹੜਾ ਘੱਗਾ ਉੱਥੇ ਮਤਲਬ ਉਹਦੇ ਨੇੜੇ ਸ਼ਹਿਰ ਆ ਸਾਡਾ ਤਹਿਸੀਲ ਪੈਂਦੀ ਹੈ ਪਾਤਲਾਂ ਉਥੇ ਘੱਗਾ ਪੁਸਤਕ ਭੰਡਾਰ ਹੈਗਾ ਆ ਉਥੋਂ ਮਿੱਲ ਜਾਂਦੀਆਂ ਹੈਗੀਆਂ ਨੇ ਅਤੇ ਕੁਝ ਜਿਹੜੀ ਹੈਗੀ ਹੈ ਜਿਵੇਂ ਆਮ ਸਟੇਸ਼ਨਰੀ ਦੀਆਂ ਕਿਤਾਬਾਂ ਹੁੰਦੀਆਂ ਪਿੰਡਾਂ ਦੇ ਵਿੱਚ ਮੇਰੇ ਪਿੰਡ ਦੇ ਵਿੱਚ ਵੀ ਇੱਕ ਕਿਤਾਬ ਇਸੇ ਨਾਂ ਦੀ ਹੈ ਘੱਗਾ ਪੁਸਤਕ ਭੰਡਾਰ ਦੇ ਵਿੱਚ ਘੱਗਾ ਪੁਸਤਕ ਭੰਡਾਰ ਜਾ ਕੇ ਇੱਕ ਪਾਤਲਾ ਸ਼ੋਪ ਹੈ ਵੱਡੀ ਸ਼ੋਪ ਹੈ ਇੱਕ ਛੋਟੀ ਦਰਮਿਆਨੀ ਦੁਕਾਨ ਹੈ ਮੇਰੇ ਪਿੰਡ ਦੇ ਵਿੱਚ ਘੱਗੇ ਤੋਂ ਹੀ ਉਹਦਾ ਨਾਂ ਰੱਖਿਆ ਘੱਗਾ ਪੁਸਤਕ ਭੰਡਾਰ ਹੈ ਆਮ ਸਟੇਸ਼ਨਰੀ ਦੀ ਸ਼ੋਪ ਹੈ ਉਥੋਂ ਵੀ ਮਤਲਬ ਸੈਕਿੰਡ ਹੈਂਡ ਕਿਤਾਬਾਂ ਜਿਹੜੀਆਂ ਹੈਗੀਆਂ ਨੇ ਉਹ ਸਿਲੇਬਸ ਦੀਆਂ ਅਤੇ ਹੋਰ ਵੀ ਮਿਲ ਜਾਂਦੀਆਂ ਹੈਗੀਆਂ ਅਸਾਨੀ ਦੇ ਨਾਲ ਸਸਤੇ ਰੇਟਾਂ ਦੇ ਉੱਤੇ ਹਾਂਜੀ ਥੈਕ ਯੂ